ਸਾਡੀ ਉਹ ਜਿਹੜੀਆਂ ਪਰੰਪਰਾਵਾਂ ਨੇ ਅਲੋਪ ਹੋ ਰਹੀਆਂ ਨੇ ਜਿਵੇਂ ਕਿ ਜਿਵੇਂ ਪਹਿਲਾਂ ਵਾਲੇ ਤਿਉਹਾਰ ਸੀ ਅਸੀਂ ਬਹੁਤ ਹੀ ਰੀਝਾਂ ਨਾਲ ਪਰੰਪਰਾ ਦੇ ਅਕੋਰਡਿੰਗ ਮਨਾਉਂਦੇ ਸੀ ਅੱਜ ਕੱਲ੍ਹ ਉਹ ਜਿਹੜੀ ਸਭ ਚੀਜ਼ਾਂ ਨਾ ਖਤਮ ਹੋ ਚੁੱਕੀਆਂ ਨੇ ਅੱਜ ਕੱਲ੍ਹ ਸਿਰਫ ਇੱਕ ਪੈਸੇ ਨੂੰ ਲੈ ਕੇ ਜਾਂ ਇੱਕ ਸ਼ੋਅ ਓਫ ਨੂੰ ਲੈ ਅਸੀਂ ਉਹਨਾਂ ਨੂੰ ਅਲੋਪ ਕਰ ਰਹੇ ਹਾਂ ਕੁਝ ਅਜਿਹੀਆਂ ਜਿਵੇਂ ਇੱਕ ਮਿੰਟ ਜਿਵੇਂ ਕਿ ਮਿੱਟੀ ਨਾਲ ਘਰ ਬਣਾਉਣੇ ਜਾਂ ਕੁਛ ਵੀ ਆ ਉਹ ਜਿਹੜੀਆਂ ਅੱਜ ਕੱਲ੍ਹ ਸ਼ੈਲੀਆਂ ਨੇ ਉਹ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚੋਂ ਵੀ ਖਤਮ ਹੋ ਰਹੀਆਂ ਨੇ ਉਹਨਾਂ ਨੂੰ ਸੰਭਾਲਣ ਦੀ ਲੋੜ ਤਾਂ ਕਰਕੇ ਆ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਪੀੜ੍ਹੀਆਂ ਨੂੰ ਆਪਣੇ ਜਿਹੜੀਆਂ ਪੁਰਾਤਨ ਸਾਡੇ 'ਚ ਸੱਭਿਆਚਾਰਕ ਸੀ ਉਹ ਅੱਗੇ ਦੇ ਸਕੀਏ ਜਿਹੜੀਆਂ ਕਿ ਅੱਜ ਕੱਲ੍ਹ ਅਸੀਂ ਨਹੀਂ ਦੇ ਪਾ ਰਹੇ